ਹੈਲੋ ਮੈਂ ਸਿਮਰਪ੍ਰੀਤ ਸਿੰਘ ਬੋਲ ਰਿਹਾ ਹਾਂ ਅਤੇ ਮੈਂ ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਯਤਨਾਂ ਬਾਰੇ ਦੱਸਣਾ ਚਾਹੁੰਦਾ ਹਾਂ ਪਹਿਲਾਂ ਯਤਨ ਆਪਣੇ ਘਰਾਂ ਦੇ ਪੁਰਾਣੇ ਬਜ਼ੁਰਗ ਇਹ ਕਰ ਸਕਦੇ ਹਨ ਕਿ ਉਹ ਆਪਣੇ ਬੱਚੇ ਬੱਚਿਆਂ ਨੂੰ ਆਪਣੇ ਪੋਤੇ ਪੋਤੀਆਂ ਨੂੰ ਮਤਲਬ ਆਪਣੀ ਨਵੀਂ ਪੀੜੀ ਨੂੰ ਪੰਜਾਬੀ ਬਾਰੇ ਦੱਸਣ ਉਹਦੇ ਇਤਿਹਾਸ ਬਾਰੇ ਦੱਸਣ ਤਾਂ ਜੋ ਬੱਚੇ ਬੱਚੇ ਆਪਣੇ ਪੰਜਾਬੀ ਬਾਰੇ ਇਤਿਹਾਸ ਬਾਰੇ ਜਾਣ ਸਕਣ ਅਤੇ ਉਹਨਾਂ ਨੂੰ ਇਸਦੀ ਮਹੱਤਤਾ ਪਤਾ ਲੱਗ ਸਕੇ ਤਾਂ ਜੋ ਉਹ ਆਪਣੀ ਜੜ੍ਹਾਂ ਨਾਲ ਜੁੜ੍ਹੇ ਰਹਿ ਸਕਣ ਦੂਜਾ ਯਤਨ ਇਹ ਆਪਾਂ ਇਹ ਕਰ ਸਕਦੇ ਹਾਂ ਕਿ ਆਪਾਂ ਕਿਸੇ ਵੀ ਥਾਂ ਉੱਤੇ ਦੂਸਰੀ ਭਾਸ਼ਾ ਨੂੰ ਪਹਿਲ ਦੇਣ ਨਾਲੋਂ ਮਹੱਤਤਾ ਦੇਣ ਨਾਲੋਂ ਆਪਾਂ ਪੰਜਾਬੀ ਭਾਸ਼ਾ ਨੂੰ ਪਹਿਲ ਦੇਈਏ ਕਿਤੇ ਵੀ ਆਪਾਂ ਬੋਲਣ ਲਈ ਜਾਂ ਲਿਖਣ ਲਈ ਆਪਾਂ ਪੰਜਾਬੀ ਨੂੰ ਪਹਿਲ ਦੇਣੀ ਚਾਹੀਦੀ ਹੈ ਤੀਜਾ ਯਤਨ ਆਪਾਂ ਇਹ ਕਰ ਸਕਦੇ ਹਾਂ ਕਿ ਸਾਰੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਬੋਲਣੀ ਅਤੇ ਲਿਖਣੀ ਸਿੱਖਣੀ ਕੰਪਲਸਰੀ ਕੀਤੀ ਜਾਵੇ ਤਾਂ ਜੋ ਆਪਣੀ ਨਵੀਂ ਪੀੜ੍ਹੀ ਬੱਚੇ ਪੰਜਾਬੀ ਬਾਰੇ ਜਾਣ ਸਕਣ ਉਹਦੇ ਇਤਿਹਾਸ ਬਾਰੇ ਜਾਣ ਸਕਣ ਅਤੇ ਆਪਣੇ ਜੜ੍ਹਾਂ ਨਾਲ ਜੁੜ੍ਹੇ ਰਹਿਣ ਸਮਾਜ ਦੇ ਲੋਕ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲਾਂ ਵਿੱਚ ਲਾ ਕੇ ਅਤੇ ਪੰਜਾਬੀ ਦੀ ਮਹੱਤਾਤ ਮਹੱਤਤਾ ਦੱਸ ਕੇ ਇਹਨਾਂ ਯਤਨਾਂ ਵਿੱਚ ਸ਼ਾਮਿਲ ਹੋ ਸਕਦੇ ਹਨ ਧੰਨਵਾਦ